ਸਤਿ ਸ਼੍ਰੀ ਅਕਾਲ ਜੀ ਬੱਚਿਆਂ ਲਈ ਡਰਾਇੰਗ ਜਾਂ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਸਹੀ ਉਮਰ ਉਹਨਾਂ ਦਾ ਆਹ ਦਾ ਬਚਪਨ 'ਚ ਕੀ ਬਚਪਨ ਵਿੱਚ ਕੀ ਹੁੰਦਾ ਬੱਚਾ ਫਰੈਸ਼ ਮਨ 'ਚ ਹੁੰਦਾ ਉਤੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੇਕਰ ਉਹ ਆਪਣੀ ਉਸ ਕਲਾ ਨੂੰ ਵਧੀਆ ਤਰੀਕੇ ਕਰਦਾ ਹੈ ਤਾਂ ਲੋਕ ਉਸ ਨੂੰ ਪ੍ਰੇ ਪ੍ਰੇਰਿਤ ਕਰਦੇ ਹਨ ਅਤੇ ਅੱਗੇ ਵਧਣ ਲਈ ਹੌਂਸਲਾ ਦਿੰਦੇ ਹਨ ਅਤੇ ਉਸ ਨੂੰ ਸ਼ਾਬਸ਼ੀ ਵੀ ਦਿੰਦੇ ਹਨ ਜੇਕਰ ਕੁਝ ਗਲਤ ਵੀ ਕਰਦਾ ਤਾਂ ਉਹ ਉਸ ਨੂੰ ਸਾਹਿਤ ਹੀ ਕਰਦੇ ਨੇ ਲੋਕ ਸਗੋਂ ਠੀਕ ਆ ਜੇਕਰ ਉਹ ਮਤਲਬ ਗਲਤ ਕਰਨ ਤਾਂ ਉਹ ਉਹਨੂੰ ਲੋਕ ਸਾਹਿਤ ਕਰਦੇ ਹਨ ਕਰਦੇ ਨੇ ਤਾਂ ਕਿ ਉਹਦਾ ਹੌਂਸਲਾ ਟੁੱਟੇ ਅਤੇ ਇੱਦਾਂ ਉਹ ਆਪਣਾ ਕੰਮ ਕਰਦਾ ਰਹਿੰਦਾ ਅਤੇ ਜਿਵੇਂ ਜਿਵੇਂ ਵੱਡਾ ਹੁੰਦਾ ਉਮਰ ਦੇ ਨਾਲ ਨਾਲ ਉਹਦੀ ਕਲਾਵਾਂ ਜਿਹੜੀਆਂ ਹੁੰਦੀਆਂ ਵਧੀਆ ਉਹ ਜਾਂਦੀਆਂ ਜਾਂਦੀ ਮਤਲਬ ਸਾਈਕਲਸ ਵਧੀਆ ਕਰ ਲੈਂਦਾ ਫਿਰ ਉਹ ਮਤਲਬ ਭਵਿੱਖ ਵਿੱਚ ਇੱਕ ਵੱਡੇ ਲੈਵਲ ਦਾ ਆਰਟਿਸਟ ਬਣ ਜਾਂਦਾ ਹੈ ਅਤੇ ਉਸਦਾ ਬਚਪਨ ਵਿੱਚ ਸਿੱਖਿਆ ਕੰਮ ਆਉਂਦਾ ਇਸ ਲਈ ਬੱਚਿਆਂ ਲਈ ਡਰਾਇੰਗ ਜਾਂ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਬਚਪਨਾ ਉਮਰ ਹੀ ਸਭ ਤੋਂ ਵਧੀਆ ਹੈ ਧੰਨਵਾਦ ਜੀ